ਮਿਊਚਲ ਫੰਡਜ਼ ਬੈਂਕ ਦੁਆਰਾ ਜਾਰੀ ਕੀਤਾ ਗਿਆ ਫੰਡ ਹੈ ਜੋ ਕਿ ਲੋਕਾਂ ਲਈ ਬਹੁਤ ਹੀ ਲਾਭਦਾਇਕ ਹੈ ਮਿਊਚਲ ਫੰਡਜ਼ ਵਿੱਚ ਲੋਕ ਨਿਵੇਸ਼ ਕਰ ਸਕਦੇ ਹਨ ਜੋ ਕਿ ਉਨ੍ਹਾਂ ਨੂੰ ਆਪਣੇ ਫਿਊਚਰ ਲਈ ਪੈਸਾ ਇਕੱਠਾ ਕਰਨ ਵਿੱਚ ਮਦਦ ਕਰਦਾ ਹੈ ਅਗਰ ਕਿਸੇ ਬੰਦੇ ਨੂੰ ਕਿਸੇ ਜਿਵੇਂ ਕਿ ਬਿਮਾਰੀ ਅਤੇ ਜਾਂ ਫਿਰ ਰੋਡ ਐਕਸੀਡੈਂਟ ਵਿੱਚ ਜਿਸ ਦੀ ਹੱਤਿਆ ਹੋ ਜਾਂਦੀ ਹੈ ਉਸਦੇ ਨੋਮੀਨੀ ਕੀਤੇ ਹੋਏ ਵਿਅਕਤੀ ਨੂੰ ਉਸਦੀ ਪੈਸੇ ਦੀ ਰਾਸ਼ੀ ਮਿਲ ਜਾਂਦੀ ਹੈ ਅਤੇ ਮਿਊਚਲ ਫੰਡਜ਼ ਇੱਕ ਤਰ੍ਹਾਂ ਦਾ ਬਹੁਤ ਹੀ ਚੰਗਾ ਪਲੈਟਫੋਮ ਹੈ ਪੈਸੇ ਨੂੰ ਇਨਵੈਸਟ ਕਰਨ ਦਾ ਮਿਊਚਲ ਫੰਡਜ਼ ਦੀ ਸਹਾਇਤਾ ਨਾਲ ਬਹੁਤ ਸਾਰੇ ਪੈਸੇ ਜੁੜ ਸਕਦੇ ਹਨ ਅਤੇ ਇਸ ਦੇ ਉੱਪਰ ਇੰਨਟਰਸਟ ਵੀ ਲੱਗਦਾ ਹੈ ਜੋ ਕਿ ਬਾਅਦ ਵਿੱਚ ਸਾਨੂੰ ਹੀ ਮਿਲਣਾ ਹੈ ਅਤੇ ਮੈਂ ਅੱਜ ਤੱਕ ਕਦੀ ਵੀ ਮਿਊਚਲ ਫੰਡ ਵਿੱਚ ਨਿਵੇਸ਼ ਨਹੀਂ ਕੀਤਾ ਅਗਰ ਇਨ ਫਿਊਚਰ ਮੈਂ ਨਿਵੇਸ਼ ਕਰਨਾ ਚਾਹੁੰਗੀ ਤਾਂ ਮੈਂ ਇਸ ਬਾਰੇ ਪੂਰੀ ਸਟੱਡੀ ਕਰੁੰਗੀ ਕਿ ਇਹ ਕਿਵੇਂ ਅਤੇ ਕਿਉਂ ਕਿਸ ਤਰ੍ਹਾਂ ਕੀਤਾ ਜਾਏਗਾ ਅਤੇ ਉਸ ਤੋਂ ਬਾਅਦ ਹੀ ਦੂਸਰੇ ਬੰਦੇ ਨੂੰ ਇਸ ਵਿੱਚ ਨਿਵੇਸ਼ ਕਰਨ ਬਾਰੇ ਸਲਾਹ ਦਉਂਗੀ ਬਾਕੀ ਮਿਊਚਲ ਫੰਡਜ਼ ਕਾਫੀ ਸਹਾਇਤਾ ਕਰਦਾ ਹੈ ਇੰਨਵੈਸਟਮੈਂਟ ਕਰਨ ਵਿੱਚ ਤਾਂ ਕਿ ਬੰਦੇ ਦਾ ਜੋ ਫਿਊਚਰ ਹੈ ਉਹ ਸਕਿਓਰ ਹੋ ਸਕੇ ਅਤੇ ਉਸਨੂੰ ਫਿਊਚਰ ਨੀਡਸ ਉਸਦੀ ਕੰਪਲੀਟ ਹੋ ਸਕਣ